ਹੈਲੋ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ

ਹਾਂ ਬਿਲਕੁਲ ਅੱਛਾ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਠੀਕ ਹੈ ਅੱਛਾ ਅੱਛਾ ਅੱਛਾ ਅੱਛਾ ਅੱਛਾ ਹਾਂ ਬਿਲਕੁਲ ਫਿਰ ਪਤਾ ਕਰੋ ਕਿਹੜੇ ਕਿਹੜੇ ਨੇ ਜਾਂ ਬੈਟਰ ਕਿਹੜਾ ਆਪਾਂ ਨੂੰ ਸਭ ਤੋਂ ਵਧੀਆ ਕਿਹੜਾ ਗਾ ਹਾਂ ਹਾਂ ਫੀਸ ਦਾ ਹੋ ਜਾਊ ਟਾਈਮਿੰਗ ਹੋ ਜਾਊਗੀ ਹਾਂ ਹਾਂ ਵਿਕੀ ਹਾਂ ਬਿਲਕੁਲ ਫਿਰ ਉਸ ਦੇ ਅਕੌਰਡਿੰਗ ਇਕੱਠੇ ਹੋ ਜਾਓ ਨਾ ਕਲਾਸ ਆ ਹੂੰ ਹੂੰ ਹਾਂ ਅਤੇ ਨਾਲੇ ਹਾਂ ਹਾਂ ਨਾਲੇ ਇਹ ਵੀ ਪਤਾ ਕਰੋ ਵੀ ਫਸਟ ਆਪਾਂ ਜਿਹੜੀਆਂ ਕਲਾਸਿਜ਼ ਕਦੋਂ ਤੋਂ ਸ਼ੁਰੂ ਕਰਨੀਆਂ ਨੇ ਸੈਸ਼ਨ ਦੇ ਅਕੌਰਡਿੰਗ ਜਾਂ ਕਿਹੜੀ ਕਲਾਸ ਗਰੁੱਪ ਦੇ ਅਕੌਰਡਿੰਗ ਹੈ ਨਾ ਹਾਂ ਉਹ ਸਾਰਾ ਫਿਰ ਪਤਾ ਕਰ ਲਓ ਬੈਟਰ ਕਿਹੜਾ ਗਾ ਆਪਾਂ ਨੂੰ ਜਾਣਾ ਵੀ ਈਜ਼ੀ ਕਿੱਧਰ ਜ਼ਿਆਦਾ ਲੱਗ ਰਿਹਾ ਗਾ ਹਾਂ ਇਹ ਚੀਜ਼ਾਂ ਅੱਛਾ ਹਾਂ ਜਿਹੜਾ ਆਪਾਂ ਨੂੰ ਬੈਟਰ ਲੱਗਦਾ ਗਾ ਬਸ ਉਸ ਤੋਂ ਆਪਾਂ ਫਿਰ ਸ਼ੁਰੂ ਕਰ ਲਾਂਗੇ ਤਿਆਰੀ ਬਾਕੀ ਨਾ ਓਕੇ ਓਕੇ ਹਾਂਜੀ ਇਹਦਾ ਰਿਜ਼ਲਟ ਪਤਾ ਹੋਵੇ ਹਾਂ ਹਾਂ ਇਹ ਵੀ ਠੀਕ ਹੈ ਅੱਛਾ ਹਾਂ ਫਿਰ ਉਹਦੇ ਬਾਰੇ ਪਤਾ ਕਰੋ ਹਾਂ ਠੀਕ ਹੈ ਬਿਲਕੁਲ ਓਕੇ ਜੀ ਓਕੇ ਓਕੇ ਬਾਏ